ਤਸਵੀਰਾਂ ਖਿੱਚਣ ਦਾ ਮੈਨੂੰ ਬੜਾ ਸ਼ੌਂਕ ਹੈ ਮੈਂ ਜਿੱਥੇ ਵੀ ਜਾਂਦੀ ਹਾਂ ਪਹਿਲੇ ਤਾਂ ਉੱਥੇ ਜਿੱਥੇ ਵੀ ਮੈਂ ਉਤਰੀ ਹਾਂ ਓਥੇ ਦੀ ਫ਼ੋਟੋ ਲੈਣੀ ਕਿੱਥੇ ਦਾ ਕਿਵੇਂ ਦਾ ਓਥੇ ਦਾ ਕਲਾਈਮੇਟ ਹੈਗਾ ਕਿੱਥੇ ਦੀ ਕਿਵੇਂ ਦਾ ਵਾਤਾਵਰਨ ਹੈਗਾ ਸਾਰਾ ਦੇਖ ਕੇ ਫੇਰ ਜਿੱਥੇ ਅਸੀਂ ਜਾਂਦੇ ਹਾਂ ਓਸ ਜਗ੍ਹਾ 'ਚ ਵੜ ਕੇ ਮੈਂ ਜਗ੍ਹਾ ਜਗ੍ਹਾ ਦੀਆਂ ਫੋਟੋਆਂ ਖਿੱਚਣੀਆਂ ਛੋਟੇ ਤੋਂ ਛੋਟੀ ਅੱਛੀ ਤੋਂ ਅੱਛੀ ਫ਼ੋਟੋ ਲੈਣੀ ਵਧੀਆ ਤੋਂ ਵਧੀਆ ਚੀਜ਼ ਦੇਖਣੀ ਹੈਗੀ ਐ ਜਿੱਥੇ ਵੀ ਜਾਣਾ ਜਿਵੇਂ ਅਸੀਂ ਘੁੰਮਣ ਗਏ ਬੱਚਿਆਂ ਨਾਲ ਘੁੰਮਣ ਗਏ ਸ਼ਿਮਲੇ ਘੁੰਮਣ ਗਏ ਟ੍ਰੇਨ 'ਚ ਗਏ ਮਿੰਨੀ ਟ੍ਰੇਨ 'ਚ ਗਏ ਓਥੇ ਕਿੰਨੀਆਂ ਹੀ ਗੁਫਾ ਆਉਂਦੀਆਂ ਹੈਗੀਆਂ ਟ੍ਰੇਨ 'ਚ ਬੜਾ ਅੱਛਾ ਨਜ਼ਾਰਾ ਓ ਸਭ ਦੀ ਵੀਡੀਓ ਵੀ ਬਣਾਈਆਂ ਸਭ ਦੀ ਫ਼ੋਟੋ ਵੀ ਖਿੱਚੀਆਂ ਸਭ ਫੇਰ ਉਸ ਤੋਂ ਬਾਅਦ ਅਸੀਂ ਗਏ ਕੁੱਲੂ ਮਨਾਲੀ ਘੁੰਮਣ ਕੁੱਲੂ ਮਨਾਲੀ ਦਾ ਵੀ ਨਜਾਰਾ ਬੜਾ ਹੀ ਵਧੀਆ ਹੁੰਦਾ ਓਥੇ ਵੀ ਫ਼ੋਟੋ ਤਸਵੀਰਾਂ ਲੈ ਲੈ ਕੇ ਆਪਣਾ ਮੋਬਾਈਲ ਹੀ ਫਿੱਲ ਕਰ ਲਿਆ ਅਸੀਂ ਪੂਰਾ ਬਾਕੀ ਜਿੱਥੇ ਜਾਂਦੇ ਹਾਂ ਖਿੱਚਦੇ ਈ ਰਹਿੰਦੇ ਹਾਂ ਫੋਟੋਆਂ ਆਪਣਾ ਤਸਵੀਰਾਂ ਦੇ ਨਾਲ ਸਾਨੂੰ ਨੇਚਰ ਨਾਲ ਬਹੁਤ ਪਿਆਰ ਹੈਗਾ